ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੇ ਓ ਭਾਅ ਜੀ ਉਹ ਹੈਮਰ ਮੰਗਵਾਈ ਸੀ ਹਥੌੜੀ ਅਤੇ ਉਹ ਸਹੀ ਨਹੀਂ ਉਹਦੇ ਜਦੋਂ ਵੀ ਉਹਨੂੰ ਵਰਤੋਂ ਯੂਜ ਕਰੋ ਉਹਦਾ ਦਸਤੇ ਚੋਂ ਨਿਕਲ ਆਉਂਦੀ ਆ ਉਹ ਨਹੀਂ ਨਹੀਂ ਉਹ ਉਹ ਨਹੀਂ ਉਹਨੂੰ ਪਾਣੀ 'ਚ ਵੀ ਰੱਖਿਆ ਬੜਾ ਕੁਛ ਕੀਤਾ ਆ ਅਤੇ ਉਹ ਸਹੀ ਨਹੀਂ ਗੀ ਅਤੇ ਉਹਦਾ ਉੱਪਰਲਾ ਜਿਹੜਾ ਹੈਗਾ ਪਿਛਲਾ ਪਿਛਲੀ ਸਾਈਡ ਜਿਹੜੀ ਬੈਕ ਸਾਈਡ ਉਹ ਟੁੱਟ ਵੀ ਗਈ ਉਹਦੀ ਅਸੀਂ ਤਾਂ ਸਗੋਂ ਇੰਨੀ ਵੇਟ ਕਰਕੇ ਐਮਾਜੋਨ ਤੋਂ ਮੰਗਵਾਈ ਹੈ ਇੱਥੋਂ ਸਗੋਂ ਲੋਕਲ ਮਾਰਕਿਟ ਤੋਂ ਲੈਂਦੇ ਸਸਤੀ ਮਿਲ ਜਾਂਦੀ ਅਤੇ ਮਿਲ ਵੀ ਉਹ ਉਸੇ ਵੇਲੇ ਅਵੇਲੇਵਲ ਹੋਈ ਜਾਣੀ ਸੀ ਅਸੀਂ ਐਮਾਜੋਨ ਤੋਂ ਮੰਗਵਾਈ ਕੇ ਬਰਾਂਡਰ ਸੀ ਚਲੋ ਵਧੀਆ ਹੋਵੇਗੀ ਇਹ ਤਾਂ ਬਿਲਕੁਲ ਬੇਕਾਰ ਆ ਨਾ ਕੋਈ ਕੰਮ ਦੀ ਵਰਤੋਂ ਦੀ 'ਚ ਆ ਤੇ ਨਾ ਕੁਝ ਆ ਇਹ ਜਾਂ ਤਾਂ ਇਹਨੂੰ ਰਿਪਲੇਸ ਕਰਕੇ ਦਿਓ ਅਤੇ ਜਾਂ ਸਾਡੇ ਪੈਸੇ ਰਿਟਰਨ ਕਰੋ